ਮੇਰੇ ਬਹੁਤ ਸਾਰੇ ਤਜ਼ਰਬੇ ਫੋਟੋਗਰਾਫੀ ਦੇ ਵਧੀਆ ਹਨ ਜਿਹਦੇ ਵਿੱਚ ਮੈਂ ਵਿਸ਼ੇਸ਼ ਸਨਮਾਨ ਵੀ ਜਿੱਤੇ ਹਨ ਫੋਟੋਗ੍ਰਾਫੀ ਦਾ ਮੇਰਾ ਇੱਕ ਅਜਿਹੀ ਰੁਚੀ ਹੈ ਜਿਹੜੀ ਮੈਂ ਬਚਪਨ ਤੋਂ ਸਿੱਖਣਾ ਚਾਹੁੰਦਾ ਸੀ ਅਤੇ ਮੈਂ ਫੋਟੋਗ੍ਰਾਫੀ ਆਪਣੇ ਪਾਪਾ ਤੋਂ ਸਿੱਖੀ ਹੈ ਜਿਹੜੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਹਨ ਮੈਂ ਫੋਟੋਗ੍ਰਾਫੀ ਵਿੱਚ ਅਲੱਗ ਅਲੱਗ ਸਰਟੀਫਿਕੇਟ ਵੀ ਲਏ ਹਨ ਜਿਵੇਂ ਕਿ ਕਾਲਜ ਵਿੱਚ ਫਸਟ ਆਉਣਾ ਆਪਣੀ ਯੂਨੀਵਰਸਿਟੀ ਵਿੱਚ ਸੈਕਿੰਡ ਆਉਣਾ ਅਤੇ ਆਪਣੇ ਜਲੰਧਰ ਡਿਸਟ੍ਰਿਕਟ ਵਿੱਚ ਥਰਡ ਆਉਣਾ ਮੈਨੂੰ ਮੇਰੇ ਦੋਸਤ ਕਹਿੰਦੇ ਹੈ ਕਿ ਤੂੰ ਫੋਟੋਗ੍ਰਾਫੀ ਵਿੱਚ ਇੱਕ ਵਧੀਆ ਨਾਮ ਕਮਾ ਸਕਦਾ ਹੈ ਫੋਟੋਗ੍ਰਾਫੀ ਇੱਕ ਅਜਿਹੀ ਰੁਚੀ ਹੈ ਜਿਹੜੇ ਪਹਾੜਾਂ ਨਦੀਆਂ ਜਾਂ ਹੋਰ ਵਧੀਆ ਨੂੰ ਰਚਾਵਾਂ ਨੂੰ ਇੱਕ ਕੈਮਰੇ ਉੱਤੇ ਲੈ ਆਉਂਦੀ ਹੈ ਅਸੀਂ ਇਸ ਤਕਨੀਕੀ ਵਿੱਚ ਹਜੇ ਇੰਨੇ ਅੱਗੇ ਨਹੀਂ ਪਹੁੰਚੇ ਹਨ ਫੋਟੋਗ੍ਰਾਫੀ ਮੇਰੇ ਲਈ ਇੱਕ ਰੁਚੀ ਨਹੀਂ ਹੈ ਫੋਟੋਗ੍ਰਾਫੀ ਮੇਰੇ ਲਈ ਇੱਕ ਤਰ੍ਹਾਂ ਦੀ ਜ਼ਿੰਦਗੀ ਹੈ